ਸਤਿ ਸ਼੍ਰੀ ਅਕਾਲ ਜੀ ਵੈਸੇ ਤਾਂ ਪੰਜਾਬ ਦੇ ਵਿੱਚ ਬਹੁਤ ਹੀ ਸਾਰੀਆਂ ਪ੍ਰਮੁੱਖ ਸਥਾਨ ਹਨ ਜਿਨ੍ਹਾਂ ਤੋਂ ਅਸੀਂ ਭੋਜਨ ਖਾ ਸਕਦੇ ਹਾਂ ਪਰ ਅੱਜ ਮੈਂ ਇੱਕ ਪ੍ਰਮੁੱਖ ਸਥਾਨ ਦੇ ਬਾਰੇ ਦੱਸਣ ਜਾ ਰਹੀ ਹਾਂ ਜਿਸ ਦਾ ਨਾਮ ਹੈ ਪਹਿਲਵਾਨ ਦਾ ਢਾਬਾ ਪਹਿਲਵਾਨ ਦਾ ਢਾਬਾ ਇਹ ਦਰਬਾਰ ਸਾਹਿਬ ਦੇ ਲਾਗੇ ਹੈ ਅਤੇ ਜਿਹੜੀ ਵੀ ਸੰਗਤ ਦਰਬਾਰ ਸਾਹਿਬ ਜਾਂਦੀ ਹੈ ਉਹ ਇਸ ਢਾਬੇ ਤੋਂ ਕੁਝ ਨਾ ਕੁਝ ਖਾ ਕੇ ਜ਼ਰੂਰ ਆਉਂਦੀ ਹੈ ਮੈਂ ਵੀ ਇੱਕ ਵਾਰ ਇਸ ਢਾਬੇ ਵਿੱਚ ਗਈ ਸੀ ਅਤੇ ਇਸ ਢਾਬੇ ਵਿੱਚ ਖਾਣ ਪੀਣ ਦਾ ਸਮਾਨ ਬਹੁਤ ਹੀ ਜ਼ਿਆਦਾ ਸਵਾਦ ਹੁੰਦਾ ਹੈ ਜਿਸ ਨੂੰ ਖਾ ਕੇ ਮਨ ਨੂੰ ਬਹੁਤ ਹੀ ਜ਼ਿਆਦਾ ਸੰਤੁਸ਼ਟੀ ਮਿਲਦੀ ਹੈ ਅਤੇ ਮੂੰਹ ਦਾ ਸਵਾਦ ਵੀ ਬਹੁਤ ਬਦਲ ਜਾਂਦਾ ਹੈ ਇਹ ਢਾਬੇ ਦਾ ਰੇਟ ਵੀ ਬਹੁਤ ਘੱਟ ਹੈ ਅਤੇ ਦੂਰ ਦੂਰ ਦੇ ਲੋਕ ਵੀ ਇਸ ਢਾਬੇ ਵਿੱਚ ਖਾਣ ਨੂੰ ਆਉਂਦੇ ਹਨ ਇਸ ਢਾਬੇ ਦਾ ਬਹੁਤ ਹੀ ਜ਼ਿਆਦਾ ਉੱਚਾ ਨਾਮ ਹੈ ਅੰਮ੍ਰਿਤਸਰ ਦੇ ਵਿੱਚ ਹੀ ਨਹੀਂ ਮਤ ਬਲਕਿ ਹੋਰ ਵੀ ਜਗ੍ਹਾਵਾਂ 'ਤੇ ਇਸ ਢਾਬੇ ਨੂੰ ਬਹੁਤ ਹੀ ਜ਼ਿਆਦਾ ਮੰਨਿਆ ਜਾਂਦਾ ਹੈ ਇਸ ਢਾਬੇ ਦੇ ਵਿੱਚ ਬਹੁਤ ਹੀ ਜ਼ਿਆਦਾ ਖਾਣ ਪੀਣ ਦੀਆਂ ਸਮਾਨ ਹੈ ਜਿਹੜਾ ਕਿ ਉਹਨਾਂ ਨੇ ਸ਼ੁੱਧ ਮਸਾਲਿਆਂ ਦੇ ਨਾਲ ਬਣਾਇਆ ਹੁੰਦਾ ਹੈ ਅਤੇ ਜਿਸ ਨੂੰ ਖਾ ਕੇ ਸਾਡੀ ਸਿਹਤ 'ਤੇ ਕੋਈ ਵੀ ਗਲਤ ਅਸਰ ਨਹੀਂ ਪੈਂਦਾ ਅਤੇ ਅਸੀਂ ਬਹੁਤ ਹੀ ਜ਼ਿਆਦਾ ਤੰਦਰੁਸਤ ਰਹਿੰਦੇ ਹਾਂ ਇਸ ਢਾਬੇ ਦੇ ਵਿੱਚ ਹੋਰ ਵੀ ਬਹੁਤ ਕੁਛ ਖਾਣ ਨੂੰ ਮਿਲਦਾ ਹੈ ਜਿਵੇਂ ਕਿ ਦਾਲ ਮੱਖਣੀ ਪਰੌਂਠੇ ਅਤੇ ਇਨ ਢਾਬੇ ਦੇ ਕੁਛ ਸਪੈਸ਼ਲ ਖਾਣ ਪੀਣ ਦੇ ਮਸਾਲੇ ਵੀ ਹੁੰਦੇ ਹਨ ਜਿਨ੍ਹਾਂ ਨੂੰ ਲੋਕ ਸਪੈਸ਼ਲ ਖਾਣ ਜਾਂਦੇ ਹਨ ਇਸ ਢਾਬੇ ਨੂੰ ਦੇਖਣ ਨੂੰ ਵੀ ਇਹ ਢਾਬਾ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਹੈ ਧੰਨਵਾਦ ਜੀ